ਮੈਨੂੰ ਬਚਪਨ ਤੋਂ ਕਿਤਾਬਾਂ ਪੜ੍ਹਨ ਦਾ ਬਹੁਤ ਸ਼ੌਂਕ ਹੈ ਜਦੋਂ ਮੈਂ ਛੋਟੀ ਹੁੰਦੀ ਸੀ ਉਦੋਂ ਮੈਂ ਘਰ ਵਿੱਚ ਹੀ ਕਹਾਣੀਆਂ ਅਤੇ ਕਵਿਤਾਵਾਂ ਦੀਆਂ ਕਿਤਾਬਾਂ ਪੜ੍ਹਦੀ ਸੀ ਜਦੋਂ ਮੈਂ ਥੋੜ੍ਹੀ ਸਕੂਲ ਚਲੀ ਗਈ ਤਾਂ ਉੱਥੇ ਫਿਰ ਸਕੂਲ ਦੀ ਲਾਈਬ੍ਰੇਰੀ ਤੋਂ ਲੈ ਕੇ ਇਸ਼ੂ ਕਰਵਾ ਕੇ ਉਥੋਂ ਕਿਤਾਬਾਂ ਪੜ੍ਹਨੀਆਂ ਸ਼ੁਰੂ ਕੀਤੀਆਂ ਨਾਵਲ ਹੋ ਗਏ ਕਵਿਤਾਵਾਂ ਹੋ ਗਈਆਂ ਚੁਟਕਲੇ ਹੋ ਗਏ ਇਹ ਵਾਲ਼ੀਆਂ ਅਤੇ ਮੇਰੀਆਂ ਬਹੁਤ ਸਾਰੀਆਂ ਪਸੰਦੀਦਾ ਸ਼ੈਲੀਆਂ ਹਨ ਜਿਵੇਂ ਕਿ ਅਮ੍ਰਿਤਾ ਪ੍ਰੀਤਮ ਦੀਆਂ ਜਿੰਨੀਆਂ ਵੀ ਜਿੰਨੇ ਵੀ ਉਹਨਾਂ ਦੇ ਨੋਬਲਸ ਨੇ ਜਿੰਨੀਆਂ ਵੀ ਉਹਦੀਆਂ ਕਹਾਣੀਆਂ ਨੇ ਉਹ ਸਾਰੀਆਂ ਮੇਰੀ ਫੇਵਰੇ ਮੇਰੀਆਂ ਪਸੰਦੀਦਾ ਸ਼ੈਲੀਆਂ ਅਤੇ ਸ਼ਿਵ ਕੁਮਾਰ ਬਟਾਲਵੀ ਜੀ ਨੇ ਦਲੀਪ ਕੌਰ ਟਿਵਾਣਾ ਜੀ ਨੇ ਸੁਰਜੀਤ ਪਾਤਰ ਜੀ ਨੇ ਇਹ ਸਾਰੀਆਂ ਮੇਰੀਆਂ ਫੇਵ ਪਸੰਦੀਦਾ ਸ਼ੈਲੀਆਂ ਹਨ ਜਿਹੜੀ ਮੇਰੀ ਬਾਕੀ ਦੀ ਜ਼ਿੰਦਗੀ ਹੈ ਉਹਦੇ 'ਚ ਸਿਰਫ ਇੱਕ ਸ਼ੈਲੀ ਦੀਆਂ ਕਿਤਾਬਾਂ ਤਾਂ ਨਹੀਂ ਮੈਂ ਪੜ੍ਹ ਸਕਦੀ ਇੱਕ ਸਾਹਿਤ ਨੂੰ ਨਹੀਂ ਪੜ੍ਹ ਸਕਦੀ ਉਹਦੇ 'ਚ ਮੇ ਕਿਉਂਕਿ ਮੇਰਾ ਜਿਹੜਾ ਟੇਸਟ ਹੈ ਉਹ ਅਲੱਗ ਹੈ ਮੈਂ ਹਰ ਇੱਕ ਚੀਜ਼ ਨੂੰ ਦੇਖਣਾ ਚਾਹੁੰਦੀ ਹਾਂ ਹਰ ਇੱਕ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਮੈਂ ਸਾਰੀਆਂ ਕਿਤਾਬਾਂ ਪੜ੍ਹੀਆਂ ਦਲੀਪ ਕੌਰ ਟਿਵਾਣਾ ਜੀ ਦੀਆਂ ਸ਼ਿਵ ਕੁਮਾਰ ਬਟਾਲਵੀ ਜੀ ਦੀਆਂ ਅੰਮ੍ਰਿਤਾ ਪ੍ਰੀਤਮ ਜੀ ਦੀਆਂ ਮੈਂ ਸਾਰੀਆਂ ਕਿਤਾਬਾਂ ਪੜ੍ਹੀਆਂ ਤਾਂ ਮੈਂ ਇੱਕ ਸ਼ੈਲੀ ਨੂੰ ਨਹੀਂ ਅਪਣਾ ਸਕਦੀ ਮੈਂ ਅਲੱਗ ਅਲੱਗ ਸ਼ੈਲੀ ਨੂੰ ਹੀ ਆਪਣਾਵਾਂਗੀ ਅਤੇ ਇਹੀ ਮੇਰੀ ਰਹਿੰਦੀ ਜ਼ਿੰਦਗੀ ਦਾ ਇੱਕ ਮਕਸਦ ਹੈ ਕਿਤਾਬਾਂ ਪੜ੍ਹ ਕੇ ਸਾਨੂੰ ਬਹੁਤ ਜ਼ਿਆਦਾ ਅਨੁਭਵ ਹੁੰਦਾ ਏ ਅਲੱਗ ਅਲੱਗ ਤਜਰਬਿਆਂ ਬਾਰੇ ਪਤਾ ਚੱਲਦਾ ਏ ਅਲੱਗ ਅਲੱਗ ਚੀਜ਼ਾਂ ਦਾ ਗਿਆਨ ਹੁੰਦਾ ਏ ਅਤੇ ਇਸ ਤਰ੍ਹਾਂ ਮੈਂ ਹੁਣ ਹਾਲ ਵਿੱਚ ਹੀ ਇੱਕ ਰਾਣੀ ਤੱਤ ਕਿਤਾਬ ਪੜ੍ਹੀ ਹੈ ਅਤੇ ਇੱਕ ਆਪਾਂ ਫੇਰ ਮਿਲਾਂਗੇ ਰਾਣੀ ਤੱਤ ਅਤੇ ਆਪਾਂ ਫੇਰ ਮਿਲਾਂਗੇ ਵਿੱਚ ਇੱਕ ਤਰ੍ਹਾਂ ਦਾ ਕਵਿਤਾਵਾਂ ਇੱਕ ਤਰ੍ਹਾਂ ਨਾਲ਼ ਸ਼ਾਇਰੀ ਹੈ ਜੋ ਮੈਨੂੰ ਬਹੁਤ ਪਸੰਦ ਹੈ ਸ਼ਾਇਰੀ ਪੜ੍ਹਨੀ ਅਤੇ ਮੈਂ ਉਹ ਹਾਲ ਵਿੱਚ ਇਹੀ ਦੋ ਕਿਤਾਬਾਂ ਪੜ੍ਹੀਆਂ ਹਨ